ਅੱਜ ਕੱਲ੍ਹ ਸੋਸਾਇਟੀ ਦੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ ਐਸਾ ਕੋਈ ਵੀ ਮਹਿਕਮਾ ਨਹੀਂ ਹੈ ਜਿੱਥੇ ਭ੍ਰਿਸ਼ਟਾਚਾਰ ਨਹੀਂ ਹੈ ਵਕੀਲ ਪੁਲਿਸ ਪੰਚਾਇਤਾਂ ਜਾਂ ਤਹਿਸੀਲ ਦਫ਼ਤਰ ਦੇ ਲੋਕਾਂ ਬਾਰੇ ਕਾਨੂੰਨੀ ਅਧਿਕਾਰੀਆਂ ਕੋਲੋਂ ਕੰਮ ਕਰਵਾਉਣਾ ਇੱਕ ਆਮ ਇਨਸਾਨ ਲਈ ਮੁਸ਼ਕਿਲ ਦਾ ਕਾਰਣ ਬਣਿਆ ਹੋਇਆ ਹੈ ਪੰਚਾਇਤ ਵਰਗੀ ਜਗ੍ਹਾ 'ਤੇ ਤਾਂ ਫਿਰ ਵੀ ਲੋਕਾਂ ਨੂੰ ਸਸਤਾ ਅਤੇ ਟਾਈਮ 'ਤੇ ਇਨਸਾਫ ਮਿਲ ਜਾਂਦਾ ਹੋਊਗਾ ਲੇਕਿਨ ਅਗਰ ਤੁਸੀਂ ਕਿਸੇ ਵਕੀਲ ਜਾਂ ਕਿਸੇ ਪੁਲਿਸ ਦੇ ਹੱਥੀ ਚੜ ਜਾਂਦੇ ਹੋ ਤਾਂ ਉੱਥੇ ਜਾਂ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਉਹ ਕਿਸੇ ਨੂੰ ਨਹੀਂ ਬਖਸ਼ਦੇ ਅਤੇ ਭ੍ਰਿਸ਼ਟਾਚਾਰ ਇਹਨਾਂ ਮਹਿਕਮਿਆਂ 'ਚ ਬਹੁਤ ਵੱਧ ਚੁੱਕਿਆ ਹੈ ਕਿਉਂਕਿ ਪੁਲਿਸ ਨੂੰ ਸਰਕਾਰੀ ਤਨਖਾਹ ਦੇ ਨਾਲ ਨਾਲ ਮਨ ਨਹੀਂ ਭਰਦਾ ਉਹ ਬਿਨਾਂ ਪੈਸੇ ਲਏ ਕਿਸੇ ਦਾ ਕੋਈ ਕੰਮ ਨਹੀਂ ਕਰਦੇ ਅਤੇ ਜੇ ਵਕੀਲਾਂ ਦੀ ਤਾਂ ਫੀਸ ਦਾ ਪਤਾ ਹੀ ਨਹੀਂ ਆ ਕਿ ਵਕੀਲਾਂ ਨੂੰ ਇਹ ਨਹੀਂ ਲੱਗਦਾ ਕਿ ਸਾਹਮਣੇ ਵਾਲਾ ਗਰੀਬ ਬੰਦਾ ਹੈ ਅਤੇ ਸਾਨੂੰ ਸਰਕਾਰ ਵੀ ਪੈਸੇ ਦੇ ਰਹੀ ਹੈ ਅਤੇ ਅਸੀਂ ਆਪਣੇ ਦਾ ਕੰਮ ਇਮਾਨਦਾਰੀ ਦੇ ਨਾਲ ਕਰੀਏ ਲੇਕਿਨ ਉਹ ਬਿਨਾਂ ਪੈਸੇ ਲਏ ਉਹ ਕੰਮ ਨਹੀਂ ਕਰਦੇ ਅਤੇ ਇਸ ਤਰ੍ਹਾਂ ਕਾਨੂੰਨੀ ਇਹਨਾਂ ਕਾਨੂੰਨੀ ਅਧਿਕਾਰੀਆਂ ਦੇ ਕਾਰਨ ਮੁਸ਼ਕਿਲ ਆਉਂਦੀ ਹੈ ਕਿਤੇ ਵੀ ਜਾਓ ਅਤੇ ਮੈਂ ਭ੍ਰਿਸ਼ਟਾਚਾਰ ਦਾ ਅਨੁਭਵ ਕੀਤਾ ਕਿ ਜਦੋਂ ਇੱਕ ਐੱਫ ਆਈ ਆਰ ਲਿਖਵਾਉਣੀ ਸੀ ਸਹੀ ਮਮੂਲੀ ਜਿਹਾ ਝਗੜਾ ਹੋਇਆ ਸੀ ਸਾਡੇ ਗੁਆਂਢ ਦੇ ਵਿੱਚ ਅਸੀਂ ਕਿਹਾ ਅਤੇ ਪੁਲਿਸ ਕਰਮਚਾਰੀਆਂ ਨੂੰ ਰਿਪੋਰਟ ਲਿਖਣ ਵਾਸਤੇ ਕਿਹਾ ਤਾਂ ਉਹਨਾਂ ਨੇ ਕੋਈ ਪਹਿਲਾਂ ਧਿਆਨ ਨਹੀਂ ਦਿੱਤਾ ਅਤੇ ਜਦੋਂ ਉਹਨਾਂ ਨੂੰ ਮੈਂ ਥੋੜ੍ਹੇ ਜਿਹੇ ਪੈਸੇ ਦੀ ਪੇਸ਼ਕਸ਼ ਕੀਤੀ ਤਾਂ ਉਹਨਾਂ ਨੇ ਖੁਦ ਬਿਠਾ ਕੇ ਮੇਰੀ ਐੱਫ ਆਈ ਆਰ ਦਰਜ ਕੀਤੀ ਅਤੇ ਮੈਨੂੰ ਲੱਗਿਆ ਕਿ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਕਰ ਸਕਦਾ ਅਤੇ ਬਹੁਤ ਬੁਰਾ ਅਨੁਭਵ ਸੀ ਮੇਰੇ ਵਾਸਤੇ ਕਿ ਸਮਾਜ ਸਿਰਫ਼ ਭ੍ਰਿਸ਼ਟਾਚਾਰ ਹੀ ਰਹਿ ਗਿਆ ਹੈ ਪੈਸਾ ਹੀ ਸਭ ਕੁਛ ਹੋ ਗਿਆ